ਅਸੀਂ ਆਹ ਜਿਹੜੇ ਆਡਰ ਦਿੰਦੇ ਹਾਂ ਜਿਵੇਂ ਪੀਜੇ ਵਗੈਰੇ 'ਤੇ ਉਹਦੇ ਕੂਪਨ ਦਾ ਪਤਾ ਕਰਨਾ ਚਾਹੁੰਦੇ ਹਾਂ ਵੈਬਸੋਟ ਖੋਲ੍ਹ ਕੇ ਵੀ ਸਾਨੂੰ ਕੋਈ ਕੂਪਨ ਵਗੈਰਾ ਮਿਲੂਗਾ ਉਹਦੇ 'ਤੇ ਵੀ ਮ ਜਿਸ ਤਰ੍ਹਾਂ ਹੁੰਦਾ ਵੀ ਇੱਕ ਪੀਜ਼ੇ ਨਾਲ ਇੱਕ ਪੀਜਾ ਫਰੀ ਜਾਂ ਪੀਜ਼ੇ ਦੇ ਨਾਲ ਕੋਕ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕੂਪਨ ਵੀ ਮਤਲਬ ਸਾਨੂੰ ਹੈਗਾ ਅੱਜ ਵੀ ਪੀਜਾ ਲੈਣਾ ਸੀਗਾ ਅਸੀਂ ਵੀ ਉਹਦੇ 'ਤੇ ਕੋਈ ਛੋਟ ਵਗੈਰਾ ਸਾਨੂੰ ਹੈਗੀ ਆ ਇਹੀ ਪਤਾ ਕਰਨਾ ਸੀ ਅਸੀਂ